ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਹਾਂਜੀ ਅੱਛਾ ਹਾਂਜੀ ਹਾਂਜੀ ਇੱਥੇ ਗੁਰਦੁਆਰੇ 'ਚ ਬਹੁਤ ਹੀ ਸਾਫ਼ ਸੁਥਰੇ ਕਮਰੇ ਹੈਗੇ ਆ ਸਾਫ਼ ਸਫ਼ਾਈ ਪੂਰੀ ਹੈਗੀ ਹੈ ਹਾਂ ਵਾਸ਼ਰੂਮ ਵੀ ਵਿੱਚ ਅਟੈਚ ਹੈਗਾ ਹੈ ਏ ਸੀ ਵੀ ਲੱਗਿਆ ਹੋਇਆ ਹੈਗਾ ਅਤੇ ਵੀ ਬਹੁਤ ਵਧੀਆ ਹੈਗਾ ਸਾਰਾ ਕੁਛ ਪਾਣੀ ਵੀ ਫਿਲਟਰ ਵਾਲਾ ਮਿਲੇਗਾ ਤੁਹਾਨੂੰ ਵਧੀਆ ਸਾਫ਼ ਸੁਥਰਾ ਅਤੇ ਵੈਸੇ ਤਾ ਗੁਰਦੁਆਰੇ ਚ ਹੀ ਜਿਵੇਂ ਨਾ ਲੰਗਰ ਵੀ ਹੁੰਦਾ ਹੈਗਾ ਵੀ ਤੁਸੀਂ ਪਾਠ ਵੀ ਸੁਣੋ ਅਤੇ ਨਾਲੇ ਚਲੋ ਲੰਗਰ ਵੀ ਖਾਓ ਪ੍ਰਸ਼ਾਦਾ ਵੀ ਖਾਓ ਬਾਹਰੋਂ ਖਾਣਾ ਤਾਂ ਤੁਹਾਡੀ ਮਰਜ਼ੀ ਹੈ ਵੀ ਹੋਟਲ ਦਾ ਖਾਣੇ ਤਾਂ ਪਰ ਗੁਰਦੁਆਰੇ 'ਚ ਵੀ ਵਧੀਆ ਚੌਵੀ ਘੰਟੇ ਵਧੀਆ ਲੰਗਰ ਚੱਲਦਾ ਹੈਗਾ ਹਾਂਜੀ ਹਾਂਜੀ ਨਾਲੇ ਤੁਸੀਂ ਮਹਾਰਾਜ ਜੀ ਦੇ ਦਰਸ਼ਨ ਕਰੋ ਮੱਥਾ ਟੇਕੋ ਨਾਲੇ ਨਾਲੇ ਪ੍ਰਸ਼ਾਦਾ ਖਾਓ ਹਾਂਜੀ ਹਾਂਜੀ ਹਾਂਜੀ ਵਧੀਆ ਮਹਾਰਾਜ ਜੀ ਤੋਂ ਉੱਤੇ ਕੀ ਹੈਗਾ ਹਾਂਜੀ ਹਾਂਜੀ ਤੁਸੀਂ ਆਓ ਜੀ ਜ਼ਰੂਰ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਵਧੀਆ ਹਾਂਜੀ ਹਾਂਜੀ ਵਧੀਆ ਇੱਥੇ ਤੁਸੀਂ ਸਵੇਰੇ ਸ਼ਾਮ ਦੋ ਟਾਈਮ ਕੀਰਤਨ ਹੁੰਦਾ ਗੁਰਦੁਆਰੇ 'ਚ ਕੀਰਤਨ ਸੁਣੋ ਨਾਲੇ ਨਾਲੇ ਰਹਿਣ ਦਾ ਵੀ ਵਧੀਆ ਰੇ ਬੰਦੋਬਸਤ ਹੈਗਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈਗਾ ਕਮਰੇ ਵੀ ਸਾਫ਼ ਸੁਥਰੇ ਹੈਗੇ ਆ ਅਤੇ ਏ ਸੀ ਵੀ ਲੱਗਿਆ ਹੋਇਆ ਹੈਗਾ ਹਾਂਜੀ ਠੀਕ ਹੈ ਓਕੇ ਹਾਂਜੀ ਹਾਂਜੀ ਓਕੇ ਸਤਿ ਸ਼੍ਰੀ ਅਕਾਲ